ਮੇਰੇ ਵੱਲੋਂ ਬਾਗ ਵਿੱਚ ਜਿਹੜੇ ਫੁੱਲ ਲਗਾਏ ਗਏ ਹਨ ਉਹਨਾਂ ਦੀ ਵਰਤੋਂ ਤਾਂ ਮੈਂ ਖਾ ਆਮ ਤੌਰ 'ਤੇ ਪੈਸੇ ਕਮਾਉਣ ਵਿੱਚ ਕਰਦਾ ਹਾਂ ਮੇਰੇ ਵੱਲੋਂ ਗੇਂਦੇ ਅਤੇ ਗੁਲਾਬ ਦੇ ਫੁੱਲ ਲਗਾਏ ਗਏ ਹਨ ਗੇਂਦੇ ਦੇ ਫੁੱਲ ਲਈ ਮੈਂ ਇੱਕ ਦੁਕਾਨਦਾਰ ਨਾਲ ਸੰਪਰਕ ਕੀਤਾ ਹੋਇਆ ਹੈ ਅਤੇ ਮੈਂ ਰੋਜਾਨ ਤੀਸਰੇ ਜਾਂ ਚੌਥੇ ਦਿਨ ਉਸ ਦੀ ਤੁੜਾਈ ਕਰਕੇ ਉਸ ਨੂੰ ਦੇ ਆਉਂਦਾ ਹਾਂ ਕਿਉਂਕਿ ਉਹ ਆਪਣੀ ਦੁਕਾਨ 'ਤੇ ਇਹਨਾਂ ਦੀ ਸੇਲ ਕਰਦਾ ਹੈ ਉ ਉਹ ਉਸ ਦੀ ਦੁਕਾਨ ਇੱਕ ਮੰਦਰ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ ਅਤੇ ਉਸ ਵੱਲੋਂ ਇਹਨਾਂ ਫੁੱਲਾਂ ਦੀ ਵਰਤੋਂ ਹਾਰ ਬਣਾਉਣ ਵਿੱਚ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਵਿਆਹ ਵਾਲੀਆਂ ਗੱਡੀਆਂ ਆਦਿ ਦੀ ਸਜਾਵਟ ਵਿੱਚ ਵੀ ਉਹਨਾਂ ਵੱਲੋਂ ਇਹ ਫੁੱਲਾਂ ਤੋਂ ਕੰਮ ਲਿਆ ਜਾਂਦਾ ਹੈ ਇਸ ਤੋਂ ਇਲਾਵਾ ਮੇਰੇ ਵੱਲੋਂ ਕਈ ਤਰ੍ਹਾਂ ਦੇ ਫ਼ਲਾਂ ਦੇ ਪੌਦੇ ਲਗਾਏ ਗਏ ਹਨ ਅਤੇ ਇਹ ਫ਼ਲ ਤਾਂ ਆਮ ਤੌਰ 'ਤੇ ਮੈਂ ਆਪਣੇ ਘਰ ਵਿੱਚ ਹੀ ਵਰਤੋਂ ਕਰਦਾ ਹਾਂ ਇਹਨਾਂ ਦਾ ਜੂਸ ਆਦਿ ਬਣਾ ਲੈਂਦਾ ਹਾਂ ਕਿਉਂਕਿ ਇਸ ਨਾਲ ਸਰੀਰ ਨੂੰ ਕਾਫੀ ਪੋਸ਼ਟਿਕ ਤੱਤ ਮਿਲਦੇ ਹਨ ਇਸ ਤੋਂ ਇਲਾਵਾ ਕਈ ਵਾਰ ਜ਼ਿਆਦਾ ਮਾਤਰਾ ਵਿੱਚ ਫ਼ਲ ਹੋ ਜਾਣ ਕਾਰਨ ਮੈਂ ਆਪਣੇ ਆਂਢ ਗੁਆਂਢ ਵਿੱਚ ਦੋਸਤਾਂ ਅਤੇ ਮਿੱਤਰਾਂ ਨੂੰ ਵੀ ਇਹ ਫ਼ਲ ਦੇ ਆਉਂਦਾ ਹਾਂ ਅਤੇ ਕਦੀ ਕਦੀ ਮੈਂ ਇਹ ਫ਼ਲ ਆਪਣੇ ਓਫਿਸ ਵੀ ਲੈ ਆਉਂਦਾ ਹਾਂ ਅਤੇ ਦੁਪਹਿਰ ਦੇ ਖਾਣੇ ਦੇ ਸਮੇਂ ਮੈਂ ਆਪਣੇ ਦੋਸਤਾਂ ਨਾਲ ਮਿਲ ਜੁਲ ਕੇ ਇਹ ਫ਼ਲ ਖਾ ਲੈਂਦਾ ਹਾਂ